ਹੈਲੋ

ਬੋਲੋ ਸਰ ਕੀ ਚਾਹੀਦਾ ਹੈਲੋ ਅੱਛਾ ਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਅੱਛਾ ਕਿਹੜੀ ਕੰਪਨੀ 'ਚ ਕੰਮ ਕਰਦੇ ਹੋ ਅੱਛਾ ਤਨਖ਼ਾਹ ਕਿੰਨੀ ਹੈ ਜੀ ਮਲਟੀਨੈਸ਼ਨਲ ਕੰਪਨੀ ਵਿੱਚ ਬਾਰਾਂ ਹਜ਼ਾਰ ਰੁਪਏ ਲੈਂਦੇ ਹੋ ਤੁਸੀਂ ਅੱਛਾ ਆਧਾਰ ਕਾਰਡ ਬਣਿਆ ਜੀ ਤੁਹਾਡਾ ਪੈਨ ਕਾਰਡ ਪੈਨ ਕਾਰਡ ਤਾਂ ਬਣਾਉਣਾ ਪੈਣਾ ਫਿਰ ਤੁਹਾਨੂੰ ਅੱਛਾ ਅੱਛਾ ਜੀ ਬਿਨਾਂ ਬਿਨਾਂ ਪੈਨ ਕਾਰਡ 'ਤੇ ਤਾਂ ਦੇਖੋ ਸਰ ਮੇਰੀ ਗੱਲ ਸੁਣੋ ਬਿਨਾਂ ਪੈਨ ਕਾਰਡ ਤੋਂ ਤਾਂ ਤੁਹਾਡਾ ਖਾਤਾ ਖੁੱਲ੍ਹਦਾ ਨਹੀਂ ਠੀਕ ਹੈ ਜੀ ਆਪਣਾ ਪਹਿਲਾਂ ਪੈਨ ਕਾਰਡ ਬਣਾਓ ਜੇ ਆਧਾਰ ਕਾਰਡ ਬਣਿਆ ਹੋਇਆ ਹੈ ਤੁਹਾਡਾ ਤਾਂ ਪੈਨ ਕਾਰਡ ਵੀ ਹੋਏਗਾ ਜੀ ਬਸ ਜੀ ਫੇਰ ਉਹਦੇ ਵਿੱਚ ਹੁੰਦੀ ਹੈ ਜੀ ਤੁਹਾਡਾ ਬਰਥ ਡੇਟ ਹੋਏਗੀ ਹਾਂ ਸਰ ਮੇਰੀ ਗੱਲ ਸੁਣੋ ਉਹਦੇ ਵਿੱਚ ਤੁਹਾਡੀ ਆਧਾਰ ਕਾਰਡ ਦੇ ਵਿੱਚ ਤੁਹਾਡੀ ਜਨਮ ਤਿਥੀ ਹੁੰਦੀ ਹੈ ਤੁਸੀਂ ਤੁਸੀਂ ਜੇ ਬਸ ਫਿਰ ਉਹਦੇ 'ਤੇ ਤੁਹਾਡਾ ਪੈਨ ਕਾਰਡ ਬਣ ਜਾਣਾ ਤੁਸੀਂ ਆਪਣੇ ਦੇਖੋ ਮੇਰੀ ਗੱਲ ਸੁਣੋ ਤੁਸੀਂ ਨਾ ਸੋਮਵਾਰ ਨੂੰ ਮੇਰੇ ਕੋਲੇ ਆ ਜਾਓ ਠੀਕ ਹੈ ਤੁਹਾਡਾ ਬੈਂਕ ਖਾਤਾ ਖੋਲ ਦੇਵਾਂਗੇ ਅਤੇ ਤੁਸੀਂ ਇੱਕ ਆਧਾਰ ਕਾਰਡ ਲੈ ਕੇ ਆਉਣਾ ਇੱਕ ਆਪਣੀ ਸੈਲਰੀ ਸਟੇਟਮੈਂਟ ਲੈ ਕੇ ਆਉਣੀ ਹੈ ਠੀਕ ਹੈ ਆਪਣਾ ਤੁਸੀਂ ਇੱਕ ਜਿੱਥੇ ਤੁਸੀਂ ਤੁਹਾਡਾ ਰਿਹਾਇਸ਼ੀ ਪਰੂਫ ਹੈ ਉਹ ਲੈ ਕੇ ਆਉਣਾ ਅਤੇ ਇੱਕ ਪੈਨ ਕਾਰਡ ਦੀ ਰਿਕੁਐਸਟ ਦੇ ਦਿਓ ਪਹਿਲਾਂ ਇੱਕ ਵਾਰੀ ਤੁਸੀਂ ਉਹ ਰਿਕੁਐਸਟ ਫਾਰਮ ਲੈ ਆਉ ਠੀਕ ਹੈ ਬਾਕੀ ਤੁਹਾਨੂੰ ਇੱਥੇ ਆ ਕੇ ਡਿਟੇਲ ਦੱਸ ਦੇਵਾਂਗੇ ਹਾਂ ਓਬਜੈਕਸ਼ਨ ਚੱਕ ਲੈ ਆਉ ਕੋਈ ਨਹੀਂ ਹਾਂ

ਤੁਹਾਡੇ ਖਾਤੇ ਵਿੱਚ ਘੱਟੋ ਘੱਟ ਜੀ ਪੰਜ ਸੌ ਰੁਪਿਆ ਰਹਿਣਾ ਚਾਹੀਦਾ ਜੀ ਦੇਖੋ ਜੀ ਤੁਸੀਂ ਡਰਨਾ ਨਹੀਂ ਹੈਗਾ ਜਦ ਤੱਕ ਅਸੀਂ ਬੈਠੇ ਹਾਂ ਠੀਕ ਹੈ ਜੀ ਤੁਸੀਂ ਇੱਧਰ ਉੱਧਰ ਦੀਆਂ ਨਾਲ਼ ਦਿਆਂ ਦੀਆਂ ਤਾਂ ਗੱਲਾਂ ਜਮਾਂ ਨਹੀਂ ਸੁਣਨੀਆਂ ਜਦ ਤੱਕ ਤੁਹਾਡਾ ਤੁਸੀਂ ਸੋਮਵਾਰ ਨੂੰ ਆ ਜਾਓ ਠੀਕ ਹੈ ਮੇਰਾ ਨਾਮ ਦੇ ਦਿਓ ਮੈਂ ਤੁਹਾਨੂੰ ਆਪੇ ਤੁਹਾਡਾ ਕੰਮ ਕਰਾਦੂੰਗਾ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਇੱਕ ਮਿੰਟ ਮੈਂ ਹੋਰ ਵੀ ਕੁਛ ਕੁ ਦੇਖਣਾ ਚਲੋ ਠੀਕ ਹੈ ਸਰ ਕੋਈ ਨਹੀਂ ਫਿਰ ਆ ਕੇ ਆਪਾਂ ਗੱਲ ਕਰ ਲੈਂਦੇ ਹਾਂ ਚੰਗਾ ਜੀ ਸਤਿ ਸ਼੍ਰੀ